ਹਾਂਜੀ ਸਰ ਵੋਲਵੋ ਬੱਸ ਸਰਵਿਸ ਹਾਊਸ ਤੋਂ ਬੋਲਦੇ ਸਰ ਮੈਂ ਤਰਨਤਾਰਨ ਏਰੀਏ ਦੇ ਵਿੱਚ ਘੁੰਮਣਾ ਚਾਹੁੰਦੀ ਹਾਂ ਸਰ ਮੈਂ ਅਜਮੇਰ ਤੋਂ ਬੋਲਦੀ ਹਾਂ ਅਤੇ ਤੁਸੀਂ ਆਹ ਹੈਲਪ ਕਰੋਗੇ ਘੁੰਮਣ ਵਿੱਚ ਹਾਂਜੀ ਸਰ ਮੈਂ ਵੀਹ ਤਿੰਨ ਚੋ ਵੀਹ ਚੋਵੀ ਨੂੰ ਸਰ ਪੰਜ ਛੇ ਦਿਨਾਂ ਵਾਸਤੇ ਹਾਂਜੀ ਸਰ ਓਕੇ ਸਰ ਓਕੇ ਹਾਂਜੀ ਓਕੇ ਹਾਂਜੀ ਅਤੇ ਸਰ ਜੇ ਮੈਂ ਵਾਪਿਸ ਆਉਣਾ ਹੋਵੇ ਤਾਂ ਫਿਰ ਵੀ ਅਵੈਲੇਵਲ ਬੱਸਾਂ ਹੈ ਓਕੇ ਸਰ ਥੈਂਕ ਯੂ